ਸੋਸ਼ਲ ਮੀਡੀਆ ਅਤੇ ਔਨਲਾਈਨ ਪਲੇਟਫਾਰਮ ਪੰਜਾਬ ਵਿੱਚ ਸਿੱਖਿਆ ਵਿੱਚ ਬੜੀ ਅਹਿਮ ਭੂਮਿਕਾ ਨਿਭਾ ਰਹੀ ਹੈ ਸੋਸ਼ਲ ਮੀਡੀਆ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਅਸੀਂ ਕਈ ਚੀਜ਼ਾਂ ਐਦਾਂ ਹੈ ਕਿ ਜਿਹੜੀਆਂ ਅਸੀਂ ਔਨਲਾਈਨ ਹੀ ਕਰ ਲੈਂਦੇ ਹਾਂ ਜਿਸ ਤਰ੍ਹਾਂ ਕਿਸੇ ਸਕੂਲ ਦੇ ਬਾਰੇ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਉਣੀ ਹੈ ਅਤੇ ਅਸੀਂ ਔਨਲਾਈਨ ਹੀ ਉਸ ਸਕੂਲ ਦਾ ਸਾਰਾ ਸਟਰਕਚਰ ਦੇਖ ਲੈਂਦੇ ਹਾਂ ਕਿੰਨੀ ਫੀਸ ਹੈ ਕਿਹੜੀ ਤਰੀਕ ਤੋਂ ਕਿਹੜੀ ਤਰੀਕ ਤੱਕ ਐਡਮਿਸ਼ਨ ਹੈ ਔਰ ਸਕੂਲ ਦਾ ਸ਼ਡਿਊਲ ਕੀ ਹੈ ਔਰ ਸਾਨੂੰ ਉੱਥੇ ਜਾਣਾ ਨਹੀਂ ਪੈਂਦਾ ਅੱਜ ਕੱਲ੍ਹ ਤਾਂ ਔਨਲਾਈਨ ਹੀ ਫੀਸਾਂ ਜਮ੍ਹਾਂ ਹੋ ਜਾਂਦੀਆਂ ਹੈ ਕਿ ਜਿਹੜੀਆਂ ਸਾਨੂੰ ਬੈਂਕ 'ਚ ਜਾ ਕੇ ਲੰਬੀਆਂ ਲਾਈਨਾਂ 'ਚ ਨਹੀਂ ਲੱਗਣਾ ਪੈਂਦਾ ਤੀਸਰਾ ਆਉਂਦਾ ਇਹ ਬੈਨੀਫਿਟ ਹੈ ਕਿ ਅੱਜ ਕੱਲ੍ਹ ਬੱਚਿਆਂ ਦੇ ਰਿਜ਼ਲਟ ਔਨਲਾਈਨ ਹੈ ਸਭ ਕੁਛ ਅੱਜ ਕੱਲ੍ਹ ਬੱਚੇ ਔਨਲਾਈਨ ਹੀ ਦੇਖ ਲੈਂਦੇ ਆ ਅੱਗੇ ਤਾਂ ਉਹਨਾਂ ਨੂੰ ਕੈਫੇ ਜਾਣਾ ਪੈਂਦਾ ਸੀ ਜਾਂ ਸਾਡੇ ਜ਼ਮਾਨੇ ਵਿੱਚ ਤਾਂ ਗਜ਼ਟ ਆਉਂਦੇ ਸੀ ਅਤੇ ਗਜ਼ਟ 'ਚੋਂ ਸਾਨੂੰ ਰਿਜ਼ਲਟ ਵੇਖਣੇ ਪੈਂਦੇ ਸੀ ਪਰ ਅੱਜ ਕੱਲ੍ਹ ਦੇ ਬੱਚੇ ਔਨਲਾਈਨ ਹੀ ਸਭ ਕੁਛ ਪੇਮੈਂਟ ਕਰ ਦਿੰਦੇ ਹੈ ਜਿਵੇਂ ਬਿਜਲੀ ਦਾ ਬਿੱਲ ਦੇਖ ਲਉ ਹੋਰ ਕੋਈ ਚੀਜ਼ਾਂ ਦੇ ਬਿੱਲ ਦੇਖ ਲਉ ਅੱਜ ਕੱਲ੍ਹ ਸਭ ਕੁਛ ਸੋਸ਼ਲ ਮੀਡੀਆ 'ਤੇ ਔਨਲਾਈਨ ਹੀ ਹੋ ਰਿਹਾ ਹੈ ਔਰ ਸਿੱਖਿਆ ਵਿੱਚ ਵੀ ਸੋਸ਼ਲ ਮੀਡੀਆ ਬੜਾ ਅਹਿਮ ਭੂਮਿਕਾ ਨਿਭਾ ਰਹੀ ਹੈ ਜਿਸ ਤਰ੍ਹਾਂ ਕਰੋਨਾ ਕਾਲ ਵਿੱਚ ਹੀ ਦੇਖ ਲਉ ਕਿੰਨੀ ਦੇਰ ਸਕੂਲ ਬੰਦ ਰਹੇ ਲੇਕਿਨ ਸੋਸ਼ਲ ਮੀਡੀਆ ਔਨਲਾਈਨ ਰਾਹੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ ਅਤੇ ਬੱਚਿਆਂ ਦੇ ਸਾਲ ਬਰਬਾਦ ਹੋਣ ਤੋਂ ਬਚ ਗਏ ਕਾਫ਼ੀ ਚੀਜ਼ਾਂ ਅਸੀਂ ਔਨਲਾਈਨ ਦੇਖ ਕੇ ਆਪਣੇ ਆਪ ਨੂੰ ਸੁਰੱਖਸ਼ਿਤ ਵੀ ਫੀਲ ਕਰਦੇ ਹਾਂ ਔਰ ਪੰਜਾਬ ਵੀ ਔਨਲਾਈਨ ਸਿੱਖਿਆ ਦੇ ਵਿੱਚ ਕਾਫ਼ੀ ਅੱਛੀ ਭੂਮਿਕਾ ਨਿਭਾ ਰਹੀ ਹੈ ਸੋਸ਼ਲ ਮੀਡੀਆ ਵੀ ਕਈ ਚੀਜ਼ਾਂ ਸਾਨੂੰ ਜਿਹੜੀਆਂ ਉੱਥੇ ਜਾ ਕੇ ਵਿਜ਼ਿਟ ਕਰਨੀਆਂ ਪੈਂਦੀਆਂ ਸੀ ਅੱਜ ਕੱਲ੍ਹ ਸਾਨੂੰ ਔਨਲਾਈਨ ਹੀ ਸਭ ਕੁਛ ਦੇਖਣ ਨੂੰ ਮਿਲ ਰਿਹਾ ਹੈ ਅਤੇ ਅਸੀਂ ਨੌਲਜ ਵੀ ਔਨਲਾਈਨ ਗੇਮ ਕਰ ਸਕਦੇ ਹਰ ਖੇਤਰ ਵਿੱਚ ਸਿੱਖਿਆ ਦੇ ਵਿੱਚ ਕਿ ਹੋਰ ਵੀ ਕਈ ਖੇਤਰਾਂ ਦੇ ਵਿੱਚ ਅਸੀਂ ਔਨਲਾਈਨ ਸਭ ਕੁਛ ਗੇਨ ਕਰਦੇ ਹਾਂ ਔਰ ਸੋਸ਼ਲ ਮੀਡੀਆ 'ਤੇ ਔਨਲਾਈਨ ਪਲੇਟਫਾਰਮ ਪਾ ਪੰਜਾਬ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਾਂ